ਖੇਡਾਂ ਲੋਕਾਂ ਨੂੰ ਅੱਜ ਦੇ ਸਮੇਂ ਵਿੱਚ ਇਕੱਠਾ ਕਰਕੇ ਰੱਖਦੀਆਂ ਹਨ ਗੱਲ ਕਰ ਲਈਏ ਟੂਰਨਾਮੈਂਟ ਦੀ ਅਖਾੜਿਆਂ ਦੀ ਜਿਸ ਵਿੱਚ ਕਿ ਅਲੱਗ ਅਲੱਗ ਪਿੰਡਾਂ ਤੋਂ ਖਿਲਾੜੀ ਪਹੁੰਚਦੇ ਨੇ ਅਤੇ ਦੇਖਣ ਵਾਲੇ ਸਰੋਤੇ ਵੀ ਪਹੁੰਚਦੇ ਨੇ ਇਹ ਸਿਹਤ ਲਈ ਵੀ ਅਤੇ ਖਿਡਾਰੀਆਂ ਲਈ ਵੀ ਬਹੁਤ ਜ਼ਰੂਰੀ ਹੈ ਅਤੇ ਸਰੋਤਿਆਂ ਨੂੰ ਇੱਕ ਮਨੋਰੰਜਨ ਦੇ ਤੌਰ 'ਤੇ ਵੀ ਗੱਲ਼ ਕਰ ਲਈਏ ਤਾਂ ਇਕੱਠਾ ਕਰਕੇ ਰੱਖਦੀਆਂ ਹਨ ਪਹਿਲਾਂ ਪਹਿਲਾਂ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਟੂਰਨਾਮੈਂਟ ਅਤੇ ਅਖਾੜੇ ਲੱਗਦੇ ਸੀ ਕਿਉਂਕਿ ਅਜੋਕੇ ਸਮੇਂ ਵਿੱਚ ਅੱਗੇ ਅੱਗੇ ਘਟਦੇ ਜਾ ਰਹੇ ਨੇ ਸਾਨੂੰ ਲੋੜ ਹੈ ਕਿ ਇਹਨੂੰ ਅੱਜ ਕੱਲ੍ਹ ਹੋਰ ਆਪਣੀ ਜ਼ਿੰਦਗੀ ਵਿੱਚ ਵਧਾਵਾ ਦਈਏ ਅਤੇ ਵੱਧ ਤੋਂ ਵੱਧ ਕ ਆਪਣੇ ਖੇਤਰ ਵਿੱਚ ਟੂਰਨਾਮੈਂਟ ਅਤੇ ਅਖਾੜੇ ਲਵਾਈਏ